ਪੰਜਾਬ ਦਾ ਸੱਭਿਆਚਾਰ ਅਤੇ ਇਸਦੇ ਇਤਿਹਾਸ ਅਤੇ ਭੂੰਗੋਲ 'ਤੇ ਬਹੁਤ ਡੂੰਘਾ ਪ੍ਰਭਾਵ ਆ ਜਿਵੇਂ ਕਿ ਆਪਾਂ ਦੇਖਦੇ ਹਾਂ ਵੀ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਵੀ ਜਿਹੜਾ ਸਾਡਾ ਪੰਜਾਬ ਆ ਉਹਦੇ ਵਿੱਚ ਵੀ ਜਿੰਨੇ ਵੀ ਇਤਿਹਾਸਿਕ ਪੱਖ ਤੋਂ ਜਿੰਨੇ ਵੀ ਹਮਲਾਵਰ ਆਏ ਸੀ ਉਹ ਬਾਹਰੋਂ ਆਉਂਦੇ ਸੀ ਪੰਜਾਬ 'ਤੇ ਵੀ ਜਿੰਨੇ ਵੀ ਧਾੜਵੀ ਆਏ ਵੀ ਉਹਨਾਂ ਨੂੰ ਪੰਜਾਬ ਵਿੱਚ ਦੀ ਲੰਘਣਾ ਪੈਂਦਾ ਸੀ ਤਾਂ ਉਹ ਇਕੱਲੇ ਸਾਡੇ 'ਤੇ ਹਮਲਾ ਕਰਨ ਨਹੀਂ ਆਉਂਦੇ ਸੀ ਉਹ ਆਪਣਾ ਸੱਭਿਆਚਾਰ ਆਪਣਾ ਕਲਚਰ ਆਪਣੀ ਭਾਸ਼ਾ ਆਪਣਾ ਸੱਭਿਆਚਾਰ ਆਪਣਾ ਸਾਰਾ ਬੋਲੀ ਵਰਤਾਰਾ ਸਾਰਾ ਕੁਛ ਨਾਲ ਲੈ ਕੇ ਆਉਂਦੇ ਸੀ ਜਿਸ ਕਰਕੇ ਇਹਦੇ ਇਤਿਹਾਸ 'ਤੇ ਵੀ ਇੱਥੇ ਅਲੱਗ ਅਲੱਗ ਤਰ੍ਹਾਂ ਦੇ ਲੋਕ ਅਲੱਗ ਅਲੱਗ ਸੱਭਿਆਚਾਰ ਦੇ ਲੋਕ ਆ ਕੇ ਰਹਿਣ ਲੱਗ ਗਏ ਜਿਹਦੇ ਨਾਲ ਇਤਿਹਾਸ 'ਤੇ ਡੂੰਘਾ ਅਸਰ ਪਿਆ ਸੱਭਿਆਚਾਰ ਵਿੱਚ ਅਤੇ ਜਿਹੜਾ ਭੂੰਗੋਲਿਕ ਦੀ ਗੱਲ ਕਰਦੇ ਹਾਂ ਆਪਾਂ ਭੂੰਗੋਲ ਦੇ ਤੌਰ 'ਤੇ ਭੂੰਗੋਲ ਦੇ ਤੌਰ 'ਤੇ ਇਹ ਸੀਗਾ ਕਿ ਵੀ ਜਿਹੜਾ ਪੰਜਾਬ ਆ ਉਹ ਸੱਤ ਦਰਿਆਵਾਂ ਦੀ ਪੰਜ ਦਰਿਆਵਾਂ ਦੀ ਟਾਈਮ ਟਾਈਮ ਦੇ ਨਾਲ ਨਾਲ ਉਹਨੂੰ ਪੰਜ ਦਰਿਆਵਾਂ ਦੀ ਸੱਤ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਇਹਦੇ ਵਿੱਚ ਇਹ ਸੀਗਾ ਕਿ ਜਿਵੇਂ ਕਿ ਇਹ ਦਰਿਆਵਾਂ ਇੱਥੇ ਪਾਣੀ ਦੀ ਵਸੋਂ ਜ਼ਿਆਦਾ ਹੋਣ ਕਾਰਣ ਇੱਥੇ ਦੇ ਜਿਹੜੇ ਖੇਤੀ ਪ੍ਰਧਾਨ ਸੀ ਕਿੱਤਾ ਸੀ ਉਹ ਬਹੁਤ ਉਪਜਾਊ ਸੀ ਵੀ ਪਹਿਲਾਂ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਭੂੰਗੋਲਿਕ ਤੋਂ ਬਹੁਤ ਅਮੀਰ ਸੀ ਅਤੇ ਉਸ ਸਮੇਂ ਵੀ ਇੰਨੀ ਜ਼ਿਆਦਾ ਖੇਤੀ ਦੀ ਉਪਜਾਊ ਸ਼ਕਤੀ ਸੀ ਵੀ ਉਹਨੂੰ ਉਸ ਸਮੇਂ ਵੀ ਪੰਜਾਬ 'ਚ ਕਣਕ ਅਤੇ ਝੋਨਾ ਦੋ ਪ੍ਰਕਾਰ ਦੀ ਖੇਤੀ ਹੁੰਦੀ ਸੀ ਅਤੇ ਖੇਤੀ ਦੇ ਪੱਧਰ ਤੋਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਵੀ ਕਣਕਾਂ ਖੇਤਾਂ ਦੇ ਵਿੱਚ ਐਵੇਂ ਲਹਿਰਾਉਂਦੀਆਂ ਸੀ ਵੀ ਜਿਵੇਂ ਕਿ ਐਵੇਂ ਸੋਨਾ ਵਿਛਿਆ ਹੋਵੇ ਜਿਸ ਕਰਕੇ ਇਹਦਾ ਹੁਣ ਜੇ ਆਪਾਂ ਸੱਭਿਆਚਾਰ ਦੇ ਨਾਲ ਸੰਬੰਧ ਜੋੜੀਏ ਤਾਂ ਇਤਿਹਾਸਿਕ ਪੱਖ ਤੋਂ ਅਤੇ ਭੂੰਗੋਲਿਕ ਪੱਖ ਤੋਂ ਪੰਜਾਬ ਦਾ ਜਿਹੜਾ ਸੱਭਿਆਚਾਰ ਆ ਉਹ ਭੂੰਗੋਲ ਅਤੇ ਇਤਿਹਾਸ ਬਹੁਤ ਡੂੰਘਾ ਅਸਰ ਪਾਉਂਦਾ ਇਤਿਹਾਸ ਦੇ ਵਿੱਚ ਵੱਖ ਵੱਖ ਲੋਕ ਆਪਣਾ ਸੱਭਿਆਚਾਰ ਲੈ ਕੇ ਜਿਹਦੇ ਨਾਲ ਇਹਦਾ ਸੱਭਿਆਚਾਰ 'ਤੇ ਅਸਰ ਪਿਆ ਭੂੰਗੋਲ ਦੇ ਵਿੱਚ ਜਿਹੜਾ ਇੱਥੋਂ ਦਾ ਭੂੰਗੋਲ ਆ ਇੱਥੋਂ ਦਾ ਵਾਤਾਵਰਨ ਹੈ ਇੱਥੋਂ ਦੇ ਖੇਤ ਹੈ ਇੱਥੋਂ ਦਾ ਇੱਥੋਂ ਦਾ ਜਿਹੜਾ ਕਿੱਤਾ ਵਗੈਰਾ ਚੱਲਦਾ ਉਹਦਾ ਅਸਰ ਪੈਂਦਾ